ਭਾਰਤ ਵਿੱਚ ਬਹੁਤ ਸਾਰੇ ਤਿਓਹਾਰ ਹਨ ਜਿੱਥੇ ਕਿ ਲੋਕ ਗਿੱਧਾ ਪਾਉਂਦੇ ਹਨ ਅਤੇ ਡਾਂਸ ਕਰਦੇ ਹਨ ਪਰ ਜ਼ਿਆਦਾਤਰ ਗਿੱਧਾ ਲੋਹੜੀ 'ਤੇ ਪਾਇਆ ਜਾਂਦਾ ਹੈ ਪੰਜਾਬ ਦਾ ਇਹ ਇੱਕ ਬਹੁਤ ਹੀ ਫੇਮਸ ਤਿਓਹਾਰ ਹੈਗਾ ਹਰੇਕ ਬੰਦਾ ਲੋਹੜੀ ਨੂੰ ਮਨਾਉਂਦਾ ਹੈ ਆਪਣੇ ਬੂਹੇ ਅੱਗੇ ਅੱਗ ਬਾਲਦਾ ਹੈ ਅਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੁੰਦੇ ਹਨ ਮਿਠਾਈਆਂ ਵੀ ਵੰਡਦੇ ਹਨ ਅਤੇ ਲੋਹੜੀ ਬਾਲਦੇ ਹਨ ਅਤੇ ਕੁਛ ਬੁੱਢੀਆਂ ਜਿਹਨਾਂ ਨੂੰ ਬਾਹਲਾ ਚਾਅ ਹੁੰਦਾ ਜਾਂ ਫਿਰ ਜਿਹਨਾਂ ਘਰੇ ਮੁੰਡਾ ਹੋਇਆ ਹੁੰਦਾ ਉਹ ਵੱਡੀ ਲੋਹੜੀ ਕਰਦੇ ਹਨ ਅਤੇ ਗਿੱਧਾ ਪਾਉਂਦੇ ਹਨ ਗਿੱਧੇ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਬਹੁਤ ਹੀ ਅਧੂਰਾ ਲੱਗਦਾ ਹੈ ਲੋਕ ਆਪਣੀ ਖੁਸ਼ੀ ਜ਼ਾਹਿਰ ਕਰਨ ਲਈ ਭੰਗੜਾ ਪਾਉਂਦੇ ਹਨ ਡੈੱਕ ਲਾਉਂਦੇ ਹਨ ਅਤੇ ਵਾਧੂ ਡਾਂਸ ਕਰਦੇ ਹਨ ਜ਼ਿਆਦਾਤਰ ਬੁੱਢੀਆਂ ਬੋਲੀਆਂ ਪਾ ਕੇ ਨੱਚਦੀਆਂ ਹਨ ਅਤੇ ਆਪਣੀ ਖੁਸ਼ੀ ਦਰਸਾਉਂਦੀਆਂ ਹਨ